ਮੈਂ ਇੱਕ ਸੈਮੀਨਾਰ ਦੇ ਵਿੱਚ ਪੁਰਾਣੀਆਂ ਚੀਜ਼ਾਂ ਦੇਖੀਆਂ ਜਿਵੇਂ ਕਿ ਫੁਲਕਾਰੀ ਚਰਖਾ ਮਧਾਣੀ ਜੋ ਕਿ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀਆਂ ਉਹ ਉਹਨਾਂ ਦੇ ਵਿੱਚੋਂ ਮੇਰੀ ਜਿਹੜੀ ਸਾਰਿਆਂ ਨਾਲੋਂ ਵਧੀਆ ਯਾਦ ਰਹੀ ਜਿਹੜੀ ਚੀਜ਼ ਮੈਨੂੰ ਸਾਰਿਆਂ ਨਾਲੋਂ ਵਧੀਆ ਲੱਗੀ ਉਹ ਮੈਨੂੰ ਲੱਗੀ ਫੁਲਕਾਰੀ ਜਿਹਦੇ ਵਿੱਚ ਲੋਕ ਜਿਹੜੀ ਫੁਲਕਾਰੀ ਜਿਹੜੀ ਹੈਗੀ ਹੈਗੀ ਔਰਤ ਦੁਆਰਾ ਹੱਥ ਦੁਬਾਰਾ ਕੱਢੀ ਵੀ ਹੋਈ ਸੀ ਉਸ ਦੇ ਵਿੱਚ ਉਹਨੇ ਸਾਰੀ ਆਪਣੇ ਆਪ ਤਿਆਰ ਕੀਤੀ ਹੋਈ ਸੀ ਵੇਖਣ ਨੂੰ ਬਿਲਕੁਲ ਵੀ ਨਹੀਂ ਲੱਗ ਰਿਹਾ ਸੀਗਾ ਉਹ ਫੁਲਕਾਰੀ ਜਿਹੜੀ ਹੈਗੀ ਆ ਵੀ ਕਿਸੇ ਦੁਆਰਾ ਹੱਥ ਦੁਆਰਾ ਤਿਆਰ ਕੀਤੀ ਹੋਈ ਆ ਅੱਜ ਕੱਲ੍ਹ ਦੇਖਣ ਨੂੰ ਉਹ ਆਏ ਇਸ ਤਰ੍ਹਾਂ ਲੱਗ ਰਿਹਾ ਸੀ ਉਹ ਕਿਸੇ ਮਸ਼ੀਨੀ ਵਰਕ ਹੈਗਾ ਬਟ ਉਹ ਨਹੀਂ ਉਹ ਸੀਗੀ ਹੱਥ ਨਾਲ ਕੱਢੀ ਹੋਈ ਇੱਕ ਮੈਨੂੰ ਜਿਹੜੀ ਹੈਗੀ ਹੈਗੀ ਮਧਾਣੀ ਬਹੁਤ ਵਧੀਆ ਲੱਗੀ ਮਧਾਣੀ ਦੇ ਨਾਲ ਜਿਹੜੇ ਹੈਗੇ ਹੈਗੇ ਲੋਕ ਪੁਰਾਣੇ ਜ਼ਮਾਨੇ ਦੇ ਲੋਕ ਜਿਹੜੇ ਹੈਗੇ ਆ ਕਿ ਦੁੱਧ ਰਿੜਕਦੇ ਸੀ ਫਿਰ ਉਹਦੇ ਵਿੱਚੋਂ ਘਿਓ ਕੱਢਦੇ ਸੀਗੇ ਮੱਖਣੀ ਕੱਢਦੇ ਸੀਗੇ ਅਤੇ ਲੱਸੀ ਤਿਆਰ ਕਰਦੇ ਸੀ ਪਰ ਅੱਜ ਕੱਲ੍ਹ ਜਿਹੜੀ ਹੈਗੀ ਹੈਗੀ ਮਧਾਣੀ ਜਿਹੜੀ ਹੈਗੀ ਹੈਗੀ ਬਿਜਲੀ 'ਤੇ ਚੱਲਣ ਵਾਲੀ ਆ ਗਈ ਹੈਗੀ ਪਹਿਲਾਂ ਹੱਥਾਂ ਦੁਆਰਾ ਜਿਹੜਾ ਹੈਗਾ ਹੈਗਾ ਮਧਾਣੀ ਰਾਹੀਂ ਘਿਓ ਕੱਢਿਆ ਜਾਂਦਾ ਸੀਗਾ ਅਤੇ ਮੈਨੂੰ ਚਰਖਾ ਜਿਹੜਾ ਹੈਗਾ ਉਹ ਵੀ ਬਹੁਤ ਵਧੀਆ ਲੱਗਿਆ ਚਰਖੇ ਰਾਹੀਂ ਲੋਕ ਜਿਹੜੇ ਹੈਗੇ ਘਰਾਂ ਦੇ ਵਿੱਚ ਜਿਹੜਾ ਹੈਗਾ ਸੂਤ ਰਾਹੀਂ ਧਾਗਾ ਜਿਹੜਾ ਤਿਆਰ ਕਰਦੇ ਸੀਗੇ ਹੁਣ ਧਾਗਾ ਜਿਹੜਾ ਹੈਗਾ ਮਸ਼ੀਨੀ ਰਾਹੀਂ ਮਸ਼ੀਨਾਂ ਰਾਹੀਂ ਤਿਆਰ ਹੁੰਦਾ ਉਹ ਯਾਦ ਰਹੀ ਜਿਹੜੀ ਮੇਰੀ ਬਹੁਤ ਹੀ ਵਧੀਆ ਰਹੀ ਜਿਹੜੀ ਮੈਨੂੰ ਕਦੇ ਵੀ ਭੁੱਲਣ ਵਾਲੀ ਨਹੀਂ ਹੈਗੀ ਇਹ ਤਿੰਨ ਚੀਜ਼ਾਂ ਮੈਨੂੰ ਬਹੁਤ ਜ਼ਿਆਦੇ ਪਸੰਦ ਆਈਆਂ ਜਿਹੜੀਆਂ ਕਿ ਦੇਖ ਕੇ ਮੈਂ ਹੁਣ ਵੀ ਉਹਨਾਂ ਨੂੰ ਯਾਦ ਕਰਕੇ ਜਿਹੜਾ ਹੈਗਾ ਮੇਰਾ ਦਿਲ ਖੁਸ਼ ਹੋ ਜਾਂਦਾ ਉੱਥੇ ਹੋਰ ਵੀ ਜਿਹੜੀਆਂ ਸੈਮੀਨਾਰ ਦੇ ਵਿੱਚ ਮੈਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਿਵੇਂ ਪੁਰਾਣੇ ਹਲ ਸੁਹਾਗਾ ਸਾਰਾ ਕੁਛ ਜਿਵੇਂ ਆਪਾਂ ਹੁਣ ਨਵਾਂ ਖੇਤੀ ਨਵੇਂ ਸੰਦ ਦੇਖਦੇ ਹਾਂ ਉਹ ਉਹਨਾਂ ਦਾ ਇੱਕ ਪੁਰਾਣਾ ਰੂਪ ਸੀ ਜਿਹੜਾ ਕਿ ਬਲਦਾਂ ਰਾਹੀਂ ਤਿਆਰ ਚਰਾਇਆ ਜਾਂਦਾ ਸੀਗਾ ਅਤੇ ਉਹ ਮੈਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਵਧੀਆ ਲੱਗਿਆ ਅਤੇ ਉਹ ਮੇਰੇ ਲਈ ਇੱਕ ਯਾਦਗਾਰ ਬਣ ਕੇ ਰਿਹਾ